ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਜਿਵੇਂ ਲੋਕਾਂ ਕੋਲ ਇਕੱਲਾ ਟੀ ਵੀ ਸੀ ਅਤੇ ਜਾਂ ਫਿਰ ਰੇਡੀਓ ਵਗੈਰਾ 'ਤੇ ਲੋਕ ਸੁਣ ਲੈਂਦੇ ਸੀਗੇ ਅਤੇ ਅੱਜ ਦੀ ਜਿਹੜੀ ਟੈਕਨੋਲਜੀ ਆ ਉਹ ਹਰੇਕ ਬੰਦੇ ਕੋਲ ਮ ਹਰੇਕ ਮਤਲਬ ਘਰ ਦੇ ਵਿੱਚ ਇਕੱਲੇ ਇਕੱਲੇ ਫੈਮਲੀ ਮੈਂਬਰ ਕੋਲ ਅਲੱਗ ਅਲੱਗ ਫੋਨ

ਅਤੇ ਯੂਟਿਊਬ 'ਤੇ ਮੈਂ ਆਪਣਾ ਜਿਵੇਂ ਗਾਣੇ ਹੋ ਗਏ ਉਹ ਸੁਣੀਦੇ ਆਂ ਅਤੇ ਆਪਣਾ ਮੂਵੀਜ਼ ਹੋਗੀਆਂ ਉਹ ਦੇਖ ਲਈ ਦੀਆਂ ਉਹਨਾਂ ਨਾਲ ਮੈਂ ਵੀ ਆਪਣਾ ਮਨੋਰੰਜਨ ਇੱਕ ਤਰ੍ਹਾਂ ਦਾ ਨਵੀਂ ਟੈਕਨੋਲਜੀ 'ਤੇ ਹੀ ਕਰ ਰਿਹਾਂ